ਮੈਂ ਕਾਫੀ ਸਾਲਾਂ ਤੋਂ ਯੋਗਾ ਕਰ ਰਹੀ ਹਾਂ ਯੋਗਾ ਜ਼ਿੰਦਗੀ ਲਈ ਇੱਕ ਨਵੀਂ ਸੇਧ ਬਣ ਕੇ ਮੇਰੀ ਜ਼ਿੰਦਗੀ 'ਚ ਆਇਆ ਅਤੇ ਇਸਨੂੰ ਇਸਨੂੰ ਕਰਨ ਤੋਂ ਬਾਅਦ ਮੈਨੂੰ ਐਂ ਲੱਗਦਾ ਕਿ ਨਾਲ ਤੁਰੰਤ ਆਪਾਂ ਨੂੰ ਨਤੀਜੇ ਨਹੀਂ ਮਿਲਦੇ ਹੌਲੀ ਹੌਲੀ ਇਹਦਾ ਜਿਹੜੇ ਨਤੀਜੇ ਨੇ ਉਹ ਸਾਹਮਣੇ ਆਉਂਦੇ ਨੇ ਜਿਵੇਂ ਸਭ ਤੋਂ ਪਹਿਲਾਂ ਜੋ ਕਿ ਅੱਜ ਦੇ ਸੰਸਾਰ ਵਿੱਚ ਅੱਜ ਦੇ ਸਮੇਂ ਵਿੱਚ ਜ਼ਰੂਰੀ ਹੈ ਮਾਨਸਿਕ ਤਣਾਓ ਨੂੰ ਦੂਰ ਕਰਦਾ ਇਹ ਯੋਗਾ ਅਤੇ ਇਹਦੇ ਨਾਲ ਮੇਰਾ ਮਨ ਕਾਫੀ ਜ਼ਿਆਦਾ ਰਿਲੈਕਸ ਰਹਿੰਦਾ ਅਤੇ ਮਾਨਸਿਕ ਤਣਾਓ ਤੋਂ ਤਾਂ ਮੈਨੂੰ ਮੁਕਤ ਕਰਦਾ ਹੀ ਹੈ ਉਸ ਤੋਂ ਬਿਨਾਂ ਸਰੀਰ ਵੀ ਕਾਫੀ ਜ਼ਿਆਦਾ ਹਲਕਾ ਮਹਿਸੂਸ ਹੁੰਦਾ ਯੋਗਾ ਕਰਨ ਤੋਂ ਬਾਅਦ ਅਤੇ ਜਦੋਂ ਯੋਗਾ ਕਰਨ ਲਈ ਅਸੀਂ ਸਮੇਂ ਸਿਰ ਉੱਠਦੇ ਹਾਂ ਤਾਂ ਬਾਕੀ ਸਾਰੇ ਕੰਮ ਸਮੇਂ ਨਾਲ ਹੁੰਦੇ ਹਨ ਇਹ ਜ਼ਿੰਦਗੀ ਦੇ ਵਿੱਚ ਇੱਕ ਸੁਧਾਰ ਆਉਂਦਾ ਤੁਸੀਂ ਆਪਣੀ ਜ਼ਿੰਦਗੀ ਨੂੰ ਇੱਕ ਵਧੀਆ ਤਰੀਕੇ ਨਾਲ ਜੀਣ ਦਾ ਢੰਗ ਸਿੱਖਦੇ ਹੋ ਇਹ ਜ਼ਿੰਦਗੀ ਜੀਣ ਦਾ ਇੱਕ ਨਵਾਂ ਢੰਗ ਹੈ ਇਸਨੂੰ ਯੋਗ ਨਹੀਂ ਕਹਿਣਾ ਚਾ ਚਾਹੀਦਾ ਯੋਗ ਦਾ ਦੂਸਰਾ ਨਾਮ ਹੀ ਇਹ ਕਿ ਜ਼ਿੰਦਗੀ ਦਾ ਨਵਾਂ ਰੂਪ ਕਿਉਂਕਿ ਜਦੋਂ ਅਸੀਂ ਯੋਗ ਕਰਦੇ ਹਾਂ ਤਾਂ ਸਾਡੇ ਸਾਰੇ ਕੰਮ ਸਮੇਂ ਨਾਲ ਹੋਣ ਲੱਗ ਜਾਂਦੇ ਹਨ ਜਦ ਸਰੀਰ ਤੰਦਰੁਸਤ ਹੈ ਤਾਂ ਸਾਰਾ ਕੁਛ ਮਨ ਨੂੰ ਵਧੀਆ ਲੱਗਦਾ ਸਰੀਰ ਨੂੰ ਯੋਗਾ ਦੀ ਜ਼ਰੂਰਤ ਹੈ ਕਿਉਂਕਿ ਜਦ ਅਸੀਂ ਸਾਰੇ ਕੰਮ ਕਰ ਰਹੇ ਹਾਂ ਤਾਂ ਆਪਣੇ ਆਪ ਲਈ ਵੀ ਸਾਨੂੰ ਸਮਾਂ ਨਿਕਾਲਣਾ ਚਾਹੀਦਾ ਖਾਸ ਕਰਕੇ ਜੋ ਘਰੇਲੂ ਮਹਿਲਾਵਾਂ ਹਨ ਉਹ ਆਪਣੇ ਲਈ ਸਮਾਂ ਨਹੀਂ ਕੱਢਦੀਆਂ ਹਨ ਤਾਂ ਆਪਣੀ ਇਸ ਰੁਝਿਵਿਆਂ ਭਰੀ ਜ਼ਿੰਦਗੀ ਵਿੱਚੋਂ ਸਾਨੂੰ ਅੱਧਾ ਘੰਟਾ ਤਾਂ ਘੱਟੋ ਘੱਟ ਕਹਿ ਰਹੀ ਹਾਂ ਮੈਂ ਘੱਟੋ ਘੱਟ ਅੱਧਾ ਘੰਟਾ ਚਲੋ ਕੰਮ ਹੁੰਦੇ ਨੇ ਘਰ ਦੇ ਦੇਣੇ ਚਾਹੀਦੇ ਹਨ ਯੋਗਾ ਲਈ ਤਾਂ ਕਿ ਸਾਰੇ ਉਹ ਵੀ ਸਾਰੇ ਤੰਦਰੁਸਤ ਰਹਿਣ ਕਿਉਂਕਿ ਮੈਨੂੰ ਆਪ ਫਾਇਦਾ ਮਿਲਿਆ ਮੈਂ ਤਾਂ ਸਾਰਿਆਂ ਨੂੰ ਇਹ ਸਜੈਸਟ ਕਰਾਂਗੀ ਕਿ ਯੋਗਾ ਜ਼ਿੰਦਗੀ ਸੱਚੀ ਬਦਲ ਦਿੰਦਾ ਧੰਨਵਾਦ